ਸਤਿ ਸ਼੍ਰੀ ਅਕਾਲ ਬਾਈ ਜੀ ਅਮਨ ਕੀ ਹਾਲ ਆ ਵਧੀਆ ਅੱਛਾ ਹੋਰ ਘਰ ਪਰਿਵਾਰ ਠੀਕ ਆ ਅੱਛਾ ਮੈਂ ਕੱਲ੍ਹ ਆ ਰਿਹਾ ਸੀਗਾ ਮੈਨੂੰ ਛੁੱਟੀਆਂ ਹੋਈਆਂ ਸੀ ਆਪਣੇ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਅਤੇ ਕੱਲ੍ਹ ਮੈਂ ਬਠਿੰਡੇ ਦਾ ਟਰਿਪ ਬਣਾਉਣਾ ਸੋਚਿਆ ਸੀ ਇੱਕ ਮੈਂ ਕਿਹਾ ਟਰਿਪ ਬਣਾ ਲੈਂਦੇ ਹਾਂ ਬਠਿੰਡੇ ਦਾ ਥੋੜ੍ਹਾ ਜਿਹਾ ਮੈਨੂੰ ਦੱਸੋਂਗੇ ਤੁਸੀਂ ਤਾਂ ਕਾਫ਼ੀ ਟਾਈਮ ਦੇ ਰਹਿੰਦੇ ਆ ਇੱਥੇ ਤੁਸੀਂ ਦੱਸੋ ਥੋੜ੍ਹਾ ਬਹੁਤਾ ਕੀ ਘੁੰਮਣ ਘੁੰਮਣ ਨੂੰ ਕੀ ਕਿੱਥੇ ਜਾ ਸਕਦੇ ਹਾਂ ਕਿੱਥੇ ਨਹੀਂ ਜਾ ਸਕਦੇ ਨਹੀਂ ਫੈਮਲੀ ਫੈਮਲੀ ਟਰਿਪ ਹੀ ਬਣਾਉਣਾ ਆਪਾਂ ਇੱਕ ਦਿਨ ਦਾ ਹੀ ਬਸ ਹਾਂ ਅੱਛਾ ਹੂੰ ਅੱਛਾ ਅੱਛਾ ਅੱਛਾ ਜੀ ਹੂੰ ਹਾਂਜੀ ਅੱਛਾ ਜੀ ਅੱਛਾ ਹੂੰ ਹੂੰ ਠੀਕ ਹੈ

ਹੂੰ ਹੂੰ ਅੱਛਾ ਜੀ ਠੀਕ ਹੈ ਠੀਕ ਹੈ ਹੂੰ ਹੂੰ ਠੀਕ ਹੈ ਠੀਕ ਹੈ ਜੀ ਅਤੇ ਤੁਸੀਂ ਫਰੀ ਹੋਊਗੇ ਫਿਰ ਆਪਾਂ ਹਾਂ ਫਿਰ ਆਪਾਂ ਮੈਂ ਕਹਿੰਦਾ ਵੀ ਆਪਾਂ ਇਕੱਠੇ ਬਣਾ ਲੈਂਦੇ ਹਾਂ ਟਰਿਪ ਤੁਸੀਂ ਵੀ ਆਇਓ ਅਤੇ ਮੈਂ ਵੀ ਆ ਜੂੰਗਾ ਨਾਲੇ ਇੰਜੋਮੈਂਟ ਹੋਜੁ ਨਾਲੇ ਆਪਾਂ ਪੁਰਾਣੇ ਦੋਸਤ ਮਿਲ ਲਾਂਗੇ ਹਾਂ ਜੀ ਹਾਂ ਠੀਕ ਹੈ ਜੀ ਆਓ ਹੁਣ ਮਿਲਦੇ ਹਾਂ ਜੀ ਸੁਬਹਾ ਸੁਬਹਾ ਆਉਂਦਾ ਮੈਂ ਫਿਰ ਤੁਹਾਡੇ ਕੋਲ ਠੀਕ ਹੈ ਜੀ ਠੀਕ ਹੈ ਜੀ ਓਕੇ